ਗੁਡ ਮੋਰਨਿੰਗ ਗੁਡ ਮੋਰਨਿੰਗ ਮੈਮ ਮੈਂ ਬੀਤੇ ਦਿਨ ਤੁਹਾਡੇ ਕੋਲ ਵੀਹ ਜਨਵਰੀ ਤੁਹਾਡੇ ਕੋਲ ਦੋ ਜੈਕਟਾਂ ਦੋ ਪੈਂਟਾ ਤੇ ਤਿੰਨ ਸ਼ਰਟਾ ਲੈ ਕੇ ਗਿਆ ਜਿੰਦੇ ਚੋਂ ਮੇਰੀ ਦੋ ਸ਼ਰਟਾਂ ਤੇ ਇੱਕ ਪੈਂਟ ਚ ਦਿੱਕਤ ਆ ਰਹੀ ਮੈਨੂੰ ਮੇਰੀ ਉਹਦੇ ਚੋਂ ਇੱਕ ਪੈਂਟ ਹੈਗੇ ਜੋ ਉਹਦੀ ਲੈਂਥ ਬਹੁਤ ਲੰਬੀ ਹੈਗੀ ਹ ਮੈਨੂੰ ਫਿਟਿੰਗ ਸਹੀ ਨਹੀਂ ਆਈ ਉਹਦੀ ਤੇ ਮੇਰੀ ਜੋ ਦੋ ਸ਼ਰਟਾ ਹੈਗੀਆ ਇੱਕ ਚ ਸਟੀਚਿੰਗ ਦੀ ਪ੍ਰੋਬਲਸਮ ਹੈਗੀ ਆ ਤੇ ਦੂਜੀ ਥੋੜੀ ਲੂਜ ਹੈਗੀ ਆ ਤੇ ਮੈਂ ਚਾਹਨਾ ਹੈਗਾ ਇਹਨੂੰ ਰਿਟੇਨ ਰਿਟਰਨ ਕਰਨਾ ਜਾਂ ਐਕਸਚੇਂਜ ਕਰਨਾ ਮੈਮ ਉਸ ਟਾਈਮ ਤੇ ਸਾਨੂੰ ਥੋੜੀ ਜਲਦੀ ਸੀਗੀ ਉਸ ਟਾਈਮ ਆਪਾਂ ਜਿਹੜੀ ਇੱਕ ਦੋ ਚੀਜ਼ਾਂ ਪਾ ਕੇ ਦੇਖੀਆਂ ਉਹਨ ਦੀ ਫਿਟਿੰਗ ਸਹੀ ਆਈ ਜੈਕਟ ਟਰਾਈ ਕੀਤੀ ਉਹਦੀ ਫੀਟਿੰਗ ਸਹੀ ਆ ਗਈ ਸ਼ਰਟ ਰਹਿ ਗਈ ਤੁਸੀਂ ਜਿਹੜੀ ਉਹਦੀ ਫੀਟਿੰਗ ਸਹੀ ਹ ਪੈਂਟ ਦੀ ਵੀ ਸਹੀ ਹ ਵਿੱਚ ਜਿਹੜੇ ਦੋ ਟਰਾਈ ਨਹੀਂ ਕੀਤੇ ਸੀਗੇ ਨਾ ਉਹਨਦੀ ਸਾਨੂੰ ਦਿੱਕਤ ਆ ਰਹੀ ਹੈਗੀ ਆ ਤੇ ਮੈਂ ਚਾਹਨਾ ਹੈਗਾ ਉਹ ਦੇਖ ਲਓ ਮੈਮ ਤੁਹਾਡੇ ਰੋਜ ਦੇ ਕਸਟਮਰ ਹੈਗੇ ਆ ਉਹ ਤਾਂ ਪੁੱਛ ਲਓ ਉਹਨਾਂ ਨੂੰ ਪੁੱਛ ਲਓ ਸਾਨੂੰ ਜਾਣਦੇ ਹੈਗੇ ਆ ਉਹਨਾਂ ਨੇ ਗੱਲ ਕਰ ਲਓ ਭਾਵੇਂ ਉਹਨਾਂ ਨੂੰ ਕਹਿ ਦੋ ਬੇਟੀ ਦਾ ਫੋਨ ਹੈਗਾ ਉਹ ਕਰ ਲੈਣਗੇ ਗੱਲ ਉਹਨਾਂ ਨੂੰ ਕੱਲ ਭਾਵੇਂ ਹਾਂਜੀ ਮੈਮ ਅਵੇਲੇਬਲ ਹੈਗੀ ਮੇਰੇ ਸਾਹਮਣੇ ਪਈ ਹੋਈ ਹੈਗੀ ਹੈ ਤੁਸੀਂ ਕਹਿੰਦੇ ਹੈਗੇ ਮੈਂ ਤੁਹਾਨੂੰ ਈਮੇਲ ਕਰ ਦਿੰਦਾ ਹੈਗਾ ਜਾਂ ਵਟਸਐਪ ਤੇ ਭੇਜ ਦਿੰਦਾ ਹਨਾ ਮੈਂ ਉਹ ਸਾਡਾ ਪੂਰਾ ਪੱਕਾ ਕੰਮ ਹੁੰਦਾ ਤੁਸੀਂ ਦੱਸ ਦਿਓ ਮੈਮ ਮੈਂ ਵਿਹਲਾ ਹੈਗਾ ਤੁਸੀਂ ਦੱਸ ਦੋ ਮੈਂ ਕਦੋਂ ਆਵਾ ਜਿਸ ਟਾਈਮ ਫਰੀ ਹੋਵੇ ਉਸ ਟਾਈਮ ਮੈਂ ਆ ਜਾਗਾ ਇਸ ਵਾਸਤੇ ਥੋੜਾ ਦੇਖ ਕੇ ਲੈ ਕੇ ਜਾਊਗਾ ਸਮਾਨ ਕੀ ਫਿਟਿੰਗ ਸਹੀ ਆਵੇ ਮੈਨੂੰ ਥੋੜੀ ਜਿਹੀ ਲੂਸ ਨਾ

ਓਕੇ ਮੈਮ ਹੋਰ ਓਕੇ ਮੈਮ